ਸਿੱਖਿਆ ਰੁਜ਼ਗਾਰ ਅਤੇ ਲੀਡਰਸ਼ਿੱਪ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਦੇ ਵਿੱਚ ਨੌਜਵਾਨਾਂ ਦੇ ਲਈ ਇੱਕ ਇੱਥੇ ਮੌਕਾ ਤਾਂ ਬਹੁਤ ਅੱਛਾ ਬਣਿਆ ਹੈ ਕਿ ਸਾਡੇ ਇੱਥੇ ਰੋਪੜ ਦੇ ਵਿੱਚ ਇੱਕ ਬਹੁਤ ਹੀ ਵਧੀਆ ਆਈ ਆਈ ਟੀ ਕੋਲੇਜ ਖੁੱਲ੍ਹਿਆ ਹੈ ਲੇਕਿਨ ਉਸ ਕੋਲੇਜ ਦੇ ਵਿੱਚ ਤੁਸੀਂ ਦਾਖਲਾ ਲੈਣ ਦੇ ਲਈ ਨੌਜਵਾਨਾਂ ਦੇ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਵੀ ਹਨ ਕਿਉਂਕਿ ਇਸਦੀ ਜਿਹੜੀ ਹੈਗੀ ਹੈ ਸਿਲੈਕਸ਼ਨ ਉਹ ਪੂਰੇ ਨੈਸ਼ਨਲ ਲੈਵਲ 'ਤੇ ਹੁੰਦੀ ਹੈ ਉੱਥੇ ਅਗਰ ਤੁਸੀਂ ਪੂਰੇ ਆਪਣਾ ਮਤਲਬ ਉੱਪਰ ਹਾਈ ਰੈਂਕ ਲੈ ਲਿਆ ਤਾਂ ਹੀ ਤੁਹਾਨੂੰ ਇੱਥੇ ਐਡਮੀਸ਼ਨ ਮਿਲੇਗੀ